ਅਗਲੀ ਪੀੜ੍ਹੀ ਨੂੰ ਇਤਿਹਾਸ ਬਾਰੇ ਪੜ੍ਹਾਉਣਾ ਬਹੁਤ ਜ਼ਰੂਰੀ ਹੈ ਇਤਿਹਾਸ ਸਿੱਖਣ ਦੇ ਬਹੁਤ ਸਾਰੇ ਫਾਇਦੇ ਹਨ ਅਤੇ ਕਹਾਣੀਆਂ ਦੇ ਰੂਪ ਵਿੱਚ ਇਸ ਨੂੰ ਪੇਸ਼ ਕਰਨਾ ਬੱਚਿਆਂ ਲਈ ਇਸ ਨੂੰ ਸਮਝਣ ਅਤੇ ਯਾਦ ਕਰਨ ਵਿੱਚ ਮਦਦ ਕਰਦਾ ਹੈ ਇਤਿਹਾਸ ਸਿੱਖਣ ਦੇ ਲਾਭ ਸੰਸਕਾਰਕ ਪਛਾਣ ਇਤਿਹਾਸ ਸਾਡੇ ਪਿਛਲੇ ਵਿਰਾਸਤ ਅਤੇ ਸੰਸਕਾਰ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਇਹ ਬੱਚਿਆਂ ਨੂੰ ਆਪਣੇ ਆਪ ਪਰਿਵਾਰ ਅਤੇ ਸਮਾਜ ਦੀ ਪਛਾਣ ਦੇਣ ਵਿੱਚ ਸਹਾਇਕ ਹੁੰਦਾ ਹੈ ਸਿੱਖਣ ਦੀ ਪ੍ਰਕਿਰਿਆ ਇਤਿਹਾਸ ਪੜ੍ਹਨ ਨਾਲ ਬੱਚੇ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਸੰਰਚਨਾਵਾਂ ਨੂੰ ਸਮਝਦੇ ਹਨ ਇਹ ਉਹਨਾਂ ਨੂੰ ਵੱਖ ਵੱਖ ਸੱਭਿਆਚਾਰਾਂ ਅਤੇ ਜੀਵਨ ਦੇ ਤਰੀਕਿਆਂ ਨਾਲ ਜਾਣੂ ਕਰਵਾਉਂਦਾ ਹੈ ਨੈਤਿਕ ਸਿੱਖਿਆ ਇਤਿਹਾਸਿਕ ਕਹਾਣੀਆਂ ਅਕਸਰ ਨੈਤਿਕਤਾ ਸਾਹਸ ਅਤੇ ਸੰਘਰਸ਼ ਦੇ ਪ੍ਰਤੀਕ ਹੁੰਦੀਆਂ ਹਨ ਇਹ ਬੱਚਿਆਂ ਨੂੰ ਸਿਖਾਉਂਦੀਆਂ ਹਨ ਕਿ ਸੱਚਾਈ ਜ਼ਿੰਮੇਵਾਰੀ ਅਤੇ ਦਇਆ ਕਿਵੇਂ ਮਹੱਤਵਪੂਰਨ ਹੈ ਆਧੁਨਿਕ ਸਮਾਜ ਦਾ ਸਮਝਣਾ ਬੱਚਿਆਂ ਨੂੰ ਸਮਾਜਿਕ ਮਸਲਿਆਂ ਅਤੇ ਉਹਨਾਂ ਦੇ ਇਤਿਹਾਸ ਨੂੰ ਸਮਝਣ ਦੀ ਸਹੂਲਤ ਮਿਲਦੀ ਹੈ ਜਿਸ ਨਾਲ ਉਹ ਆਧੁਨਿਕ ਸਮਾਜ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਨ ਕਹਾਣੀਆਂ ਸੁਣਾਉਣ ਦੇ ਫਾਇਦੇ ਰੁਚੀ ਅਤੇ ਮਨੋਰੰਜਨ ਬੱਚਿਆਂ ਨੂੰ ਕਹਾਣੀਆਂ ਸੁਣਾਉਣਾ ਉਹਨਾਂ ਦੀ ਰੁਚੀ ਨੂੰ ਵਧਾਉਂਦਾ ਹੈ ਕਹਾਣੀਆਂ ਦੇ ਰੂਪ ਵਿੱਚ ਇਤਿਹਾਸ ਪੇਸ਼ ਕਰਨ ਨਾਲ ਬੱਚੇ ਨਿਰਾਸ਼ ਨਹੀਂ ਹੁੰਦੇ ਯਾਦ ਕਰਨ ਵਿੱਚ ਸੁਵਿਧਾ ਕਹਾਣੀਆਂ ਨੂੰ ਯਾਦ ਕਰਨਾ ਆਸਾਨ ਹੁੰਦਾ ਹੈ ਬੱਚੇ ਵਿਅਕਤੀਗਤ ਅਨੁਭਵਾਂ ਅਤੇ ਪਾਤਰਾਂ ਨਾਲ ਜੋੜ ਕੇ ਇਤਿਹਾਸ ਨੂੰ ਬਿਹਤਰ ਸਮਝ ਸਕਦੇ ਹਨ ਸੰਵਾਦੀ ਸਿੱਖਿਆ ਕਹਾਣੀਆਂ ਸੁਣਾਉਣ ਸਮੇਂ ਪ੍ਰਸ਼ਨਾਂ ਅਤੇ ਚਰਚਾ ਦੇ ਮੌਕੇ ਮਿਲਦੇ ਹਨ ਜੋ ਬੱਚਿਆਂ ਨੂੰ ਵਿਸਥਾਰ ਵਿੱਚ ਸੋਚਣ ਅਤੇ ਆਪਣੇ ਵਿਚਾਰ ਸ਼ੇਅਰ ਕਰਨ ਦਾ ਮੌਕਾ ਦਿੰਦੇ ਹਨ ਇਤਿਹਾਸ ਸਿੱਖਣ ਦੇ ਤਰੀਕੇ ਕਹਾਣੀਆਂ ਸੁਣਾਉਣਾ ਇਤਿਹਾਸਿਕ ਪਾਤਰਾਂ ਜਾਂ ਘਟਨਾਵਾਂ ਦੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਓ ਜਿਵੇਂ ਕਿ ਮਹਾਤਮਾ ਗਾਂਧੀ ਦੇ ਆਜ਼ਾਦੀ ਲਾਹੇ ਦੀ ਕਹਾਣੀ ਦ੍ਰਿਸ਼ਾ ਮਾਧਿਅਮ ਫਿਲਮਾਨ ਡਾਕੂਮੈਂਟਰੀਜ ਜਾਂ ਇਤਿਹਾਸਿਕ ਵੀਡੀਓਜ ਦੁਆਰਾ ਇਤਿਹਾਸ ਦੀ ਜਾਣਕਾਰੀ ਪ੍ਰਦਾਨ ਕਰੋ ਇਤਿਹਾਸਿਕ ਗੇਮ ਜਾਂ ਪ੍ਰੋਜੈਕਟਾਂ ਵਿੱਚ ਸ਼ਾਮਿਲ ਕਰੋ ਜੋ ਬੱਚਿਆਂ ਨੂੰ ਸਿੱਖਣ ਵਿੱਚ ਮਦਦ ਕਰਦੀਆਂ ਹਨ ਯਾਤਰਾਵਾਂ ਇਤਿਹਾਸਿਕ ਥਾਵਾਂ ਦੀ ਯਾਤਰਾ ਕਰਨ ਨਾਲ ਬੱਚੇ ਸਿੱਧੇ ਤੌਰ 'ਤੇ ਇਤਿਹਾਸ ਨੂੰ ਮਹਿਸੂਸ ਕਰ ਸਕਦੇ ਹਨ ਨਤੀਜਾ ਇਤਿਹਾਸ ਸਿੱਖਣਾ ਸਿਰਫ ਜਾਣਕਾਰੀ ਦੇਣ ਦਾ ਤਰੀਕਾ ਹੀ ਨਹੀਂ ਸਗੋਂ ਇਹ ਬੱਚਿਆਂ ਨੂੰ ਸੋਚਣ ਸਮਝਣ ਅਤੇ ਆਪਣੇ ਆਸ ਪਾਸ ਦੇ ਸੰਸਾਰ ਨਾਲ ਜੁੜਨ ਵਿੱਚ ਮਦਦ ਕਰਦਾ ਹੈ ਕਹਾਣੀਆਂ ਦੇ ਰੂਪ ਵਿੱਚ ਇਤਿਹਾਸ ਸਿੱਖਣ ਨਾਲ ਇਹ ਪ੍ਰਕਿਰਿਆ ਹੋਰ ਵੀ ਰੁਚੀਕਰ ਅਤੇ ਪ੍ਰਭਾਵਸ਼ਾਲੀ ਬਣ ਜਾਂਦੀ ਹੈ